ਹੈਲੋ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਦੱਸੋ ਜੀ ਕਿਵੇਂ ਆਉਣਾ ਹੋਇਆ ਹਾਂਜੀ ਹਾਂਜੀ ਹਾਂਜੀ ਬੋਲੋ ਮੈਮ ਸ਼ਰਟ ਦੀ ਲੰਬਾਈ ਦੱਸ ਦਿਉ ਤੁਸੀਂ ਕਿੰਨੀ ਹੈ ਹਾਂਜੀ ਕਮਰ ਹਾਂਜੀ ਅਤੇ ਚੈਸਟ ਉੱਪਰੋਂ ਦੀ ਹਾਂਜੀ ਤੇ ਬਾਜੂ ਦੱਸ ਦਿਉ ਕਿੰਨੀ ਹੈ ਹਾਂਜੀ ਠੀਕ ਹੈ ਮੈਮ ਅਤੇ ਘੇਰਾ ਦੱਸ ਦਿਉ ਤੁਸੀਂ ਹਾਂਜੀ ਅਤੇ ਮੈਮ ਪਲਾਜ਼ੋ 'ਤੇ ਤੁਸੀਂ ਫਲੇਅਰ ਵਾਲਾ ਸਿਲਵਾਉਣਾ ਹੈ ਜਾਂ ਦੂਸਰਾ ਟਾਈਟ ਵਾਲਾ ਓਕੇ ਲੰਬਾਈ ਦੱਸ ਦਿਉ ਤੁਸੀਂ ਪਲਾਜ਼ੋ ਦੀ ਹਾਂਜੀ ਠੀਕ ਹੈ ਮੈਮ ਕਦੋਂ ਤੱਕ ਚਾਹੀਦਾ ਮੈਮ ਤੁਹਾਨੂੰ ਮੈਮ ਇਹਦਾ ਟੂ ਫਿਫਟੀ ਰੇਟ ਹੈਗਾ